ਜਿਹੜੇ ਮਛਿਆਰੇ ਮੱਛੀਆਂ ਫੜਦੇ ਹਨ ਮੈਨੂੰ ਇਹਨਾਂ 'ਤੇ ਬਹੁਤ ਚਿੰਤਾ ਹੁੰਦੀ ਹੈ ਕਿਉਂਕਿ ਮੱਛੀਆਂ ਸਮੁੰਦਰ ਨੂੰ ਉਹਦਾ ਖਾ ਕੇ ਜਿਹੜੀ ਕਾਈ ਵਗੈਰਾ ਸਮੁੰਦਰ ਨੂੰ ਸਾਫ ਕਰਦੀਆਂ ਮਛਿਆਰੇ ਆਪਣੇ ਜਾਲ ਸੁੱਟ ਕੇ ਉਹਦੇ ਮੱਛੀਆਂ ਫੜ ਕੇ ਉਹ ਸਮੁੰਦਰ 'ਚ ਮੱਛੀਆਂ ਖਤਮ ਕਰਦੇ ਜਿਹਦੇ ਨਾਲ ਵੀ ਆਪਣਾ ਹੁਣ ਸਮੁੰਦਰ ਦੂਸ਼ਿਤ ਰਹੇਗਾ ਲੋਕ ਗੰਦ ਪਾਉਣ ਤੋਂ ਤਾਂ ਹੱਟਦੇ ਨਹੀਂ ਪਰ ਇਹ ਮੱਛੀਆਂ ਜਿਹੜੀਆਂ ਸਮੁੰਦਰ 'ਚ ਇਹ ਆਪਣੇ ਸਮੁੰਦਰ ਨੂੰ ਸਾਫ ਰੱਖ ਸਕਦੀ ਹੈ ਮੇਰਾ ਇੱਕ ਇਹ ਸੁਝਾਅ ਹੈ ਵੀ ਆਪਣੇ ਸਰਕਾਰਾਂ ਨੂੰ ਇਹ ਮਛਿਆਰਾਂ ਨੂੰ ਮੱਛੀ ਫੜਨ ਤੋਂ ਨੇੜੇ ਤੇੜੇ ਏਰੀਏ 'ਚ ਰੋਕਣਾ ਚਾਹੀਦਾ ਹੈ